ਮੇਰਾ ਨਾਮ ਪਾਰਥ ਹੈ ਮੈਂ ਆਪਣੇ ਨੇੜੇ ਦੇ ਪੂਜਾ ਢਾਬੇ ਤੋਂ ਕੁਛ ਸਮਾਨ ਔਡਰ ਕੀਤਾ ਸੀ ਉਹ ਆਈਟਮਾਂ ਕੁਛ ਇਸ ਪ੍ਰਕਾਰ ਹੈ ਜਿਵੇਂ ਕਿ ਦਹੀਂ ਪਕੌੜੇ ਗੁਲਾਬ ਜਾਮੂਨ ਰਸ ਮਲਾਈ ਪਨੀਰ ਰਾਜਮਾਂਹ ਚਾਵਲ ਨਾਨ ਕੋਲਡਰਿੰਕ ਮੰਗਵਾਏ ਹਨ ਪਰ ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਾਅਦ ਵਿੱਚ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਇਹਨਾਂ ਸਾਰੀ ਆਈਟਮਾਂ ਦਾ ਸ ਕੈਸ਼ ਔਨ ਡਿਲੀਵਰੀ ਕਰਨਾ ਚਾਹੁੰਦਾ ਹਾਂ ਕਿਰਪਾ ਮੈਨੂੰ ਬਾਅਦ 'ਚ ਪਤਾ ਲੱਗਦਾ ਹਾਂ ਕਿ ਇਹਨਾਂ ਦੀ ਵੈਬਸਾਈਟ 'ਤੇ ਉਹ ਸਿਰਫ ਔਨਲਾਈਨ ਪੇਮੈਂਟ ਹੀ ਉਪਲਬਧ ਹਨ ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਕੈਸ਼ ਔਨ ਡਿਲੀਵਰੀ ਕਰਨ ਕਿਰਪਾ ਕਰਕੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੋ ਵੀ ਮੇਰਾ ਸਾਰਾ ਆਈਟਮਾਂ ਅਤੇ ਸ ਬਾਕੀ ਜੋ ਵੀ ਸਮਾਨ ਹੈ ਉਸ ਨੂੰ ਮੇਰੇ ਘਰ ਪਹੁੰਚਾਉਣ ਜੇ ਉਹ ਔਨਲਾਈਨ ਪੇਮੈਂਟ ਉਪਲਬਧ ਹੈ ਉਹ ਮੈਂ ਔਨਲਾਈਨ ਪੇਮੈਂਟ ਉਪਲਬਧ ਮੇਰੇ ਪਾਸ ਨਹੀਂ ਹੈ ਮੈਂ ਕਿਰਪਾ ਕਰਕੇ ਮੈਂ ਔਨਲਾਈਨ ਪੇਮੈਂਟ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਣੇ ਫੋਨ ਤੋਂ ਔਨਲਾਈਨ ਪੇਮੈਂਟ ਯੂਜ਼ ਨਹੀਂ ਕਰਦਾ ਕਿਰਪਾ ਕਰਕੇ ਮੈਂ ਸੀ ਕੈਸ਼ ਔਨ ਡਿਲਵਰੀ ਹੀ ਕਰ ਸਕਦਾ ਹਾਂ ਕਿਰਪਾ ਕਰਕੇ ਮੇਰੀ ਇਹ ਬੇਨਤੀ ਹੈ ਕਿ ਮੈਂ ਕੈਸ਼ ਔਨ ਡਿਲਵਰੀ ਹੀ ਕਰਨਾ ਚਾਹੁੰਦਾ ਹਾਂ ਜੇ ਅਗਰ ਔਨਲਾਈਨ ਪੇਮੈਂਟ ਹੀ ਹੋਵੇਗੀ ਤਾਂ ਮੇਰਾ ਇਹ ਸਾਰਾ ਸ ਆਈਟਮਾਂ ਵਗੈਰਾ ਕੈਂਸਲ ਕੀਤੀ ਜਾਵੇ